ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਰਾਮ ਚੰਦ ਜੀ ਬੋਲ ਰਹੇ ਹੋ ਮੈਂ ਔਲਾ ਤੋਂ ਇੱਕ ਕੈਬ ਬੁੱਕ ਕੀਤੀ ਸੀ ਮੈਂ ਪਟਿਆਲਾ ਤੋਂ ਰੋਪੜ ਜਾਣ ਵਾਸਤੇ ਇਹ ਕੈਬ ਬੁੱਕ ਕਰਵਾਈ ਸੀ ਇਸ ਦਾ ਟਾਈਮ ਮੈਨੇ ਗਿਆਰਾਂ ਵਜੇ ਕਿਹਾ ਸੀ ਮੈਨੂੰ ਮੈਸੇਜ ਰਾਹੀ ਤੁਹਾਡਾ ਕੰਟੈਕਟ ਨੰਬਰ ਮਿਲਿਆ ਇਸ ਲਈ ਮੈਂ ਤੁਹਾਨੂੰ ਕੋਲ ਕੀਤੀ ਅਸਲ ਦੇ ਵਿੱਚ ਮੈਨੂੰ ਤੁਸੀਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਿੱਕ ਕਰਨਾ ਸੀ ਪਰ ਮੈਨੂੰ ਕੋਈ ਜ਼ਰੂਰੀ ਕੰਮ ਆ ਗਿਆ ਜਿਸ ਕਰਕੇ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਮੋਦੀ ਕੋਲਜ ਆਈ ਹੋਈ ਹਾਂ ਇੱਥੋਂ ਮੈਨੂੰ ਤੁਸੀਂ ਪਿੱਕ ਕਰਨਾ ਅਸਲ ਦੇ ਵਿੱਚ ਮੈਨੇ ਕੋਈ ਕਾਗਜ਼ੀ ਕਾਰਵਾਈ ਕਾਰਵਾਨ ਕਰਨੀ ਸੀ ਜਿਸ ਕਰਕੇ ਮੈਨੂੰ ਪਟਿਆਲਾ ਯੂਨੀਵਰਸਿਟੀ ਤੋਂ ਮੋਦੀ ਕੋਲਜ ਆ ਕੇ ਕੰਮ ਕਰਨਾ ਪਿਆ ਇਸ ਟਾਈਮ ਦਸ ਵੱਜ ਕੇ ਪੰਦਰਾਂ ਮਿੰਟ ਹੋਏ ਹਨ ਅਤੇ ਤੁਸੀਂ ਮੈਨੂੰ ਗਿਆਰਾਂ ਵਜੇ ਪਿੱਕਅਪ ਕਰਨਾ ਹੈ ਮੇਰਾ ਹੁਣ ਦੁਬਾਰਾ ਯੂਨੀਵਰਸਿਟੀ ਜਾਣਾ ਪੋਸੀਬਲ ਨਹੀਂ ਹੈ ਅਤੇ ਮੈਂ ਤੁਹਾਨੂੰ ਇਹ ਬੇਨਤੀ ਕਰ ਰਹੀ ਹਾਂ ਕਿ ਤੁਸੀਂ ਮੈਨੂੰ ਹੁਣ ਮੋਦੀ ਕੋਲਜ ਤੋਂ ਹੀ ਪਿੱਕ ਕਰਿਓ ਕਿਉਂਕਿ ਇੱਥੇ ਮੈਨੂੰ ਅੱਧਾ ਘੰਟਾ ਹੋਰ ਲੱਗ ਜਾਵੇਗਾ ਮੇਰਾ ਰੋਪੜ ਪਹੁੰਚਣਾ ਵੀ ਟਾਈਮ 'ਤੇ ਬਹੁਤ ਜ਼ਰੂਰੀ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਹੁਣ ਗਿਆਰਾਂ ਵਜੇ ਤੱਕ ਮੋਦੀ ਕੋਲਜ ਤੋਂ ਹੀ ਪਿੱਕ ਕਰ ਲੈਣਾ